ਯੋਗਾ ਇੱਕ ਬਹੁਤ ਹੀ ਪੁਰਾਣਾ ਅਭਿਆਸ ਆ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਵਾ ਜਦੋਂ ਵੀ ਅਸੀਂ ਕੋਈ ਯੋਗਾ ਕਰਦੇ ਆਂ ਲ ਲੰਮੀ ਸਾਂ ਸਾਂਸ ਲੈਦੇ ਆਂ ਫਿਰ ਯੋਗਾ ਸ਼ੁਰੂ ਕਰਦੇ ਆਂ ਯੋਗਾ ਨਾਲ ਸਾਡਾ ਮਾਨਸਿਕ ਜਿਹੜਾ ਤਨਾਅ ਗਾ ਉਹ ਦੂਰ ਹੁੰਦਾ ਜਦੋਂ ਵੀ ਅਸੀਂ ਕੋਈ ਦੋ ਯੋਗਾ ਕਰਕੇ ਹਟਦੇ ਆਂ ਸਾਡੇ ਸਰੀਰ ਦੇ ਵਿੱਚ ਤਾਕਤ ਆਉਂਦੀ ਆ ਹਨਾ ਲਚ ਲਚੀਲਾਪਨ ਆਉਂਦਾ ਗਾ ਸਾਡੇ ਸਰੀਰ ਚ ਜਿਹੜਾ ਵੀ ਦਰਦ ਹੁੰਦਾ ਬਹੁਤ ਘੱਟ ਹੋ ਜਾਂਦਾ ਗਾ ਜੋ ਜਦੋਂ ਵੀ ਅਸੀਂ ਯੋਗਾ ਕਰਦੇ ਆਂ ਇਹਦੇ ਨਾਲ ਸਿਰਫ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ ਸਾਡਾ ਪੂਰਾ ਸਰੀਰ ਹੀ ਤੰਦਰੁਸਤ ਹੋ ਜਾਂਦਾ ਸਾਡਾ ਜਦੋਂ ਵੀ ਕੋਈ ਅਸੀਂ ਕੁਛ ਉਹਨੂੰ ਟੈਨਸ਼ਨ ਹੁੰਦੀ ਹੈ ਦਿਮਾਗੀ ਟੈਂਸ਼ਨ ਹੁੰਦੀ ਆ ਦਿਮਾਗੀ ਪਰੇਸ਼ਾਨੀ ਹੁੰਦੀ ਆ ਅਸੀਂ ਯੋਗਾ ਕਰ ਲੈਦੇ ਆਂ ਤਾਂ ਸਾਡਾ ਜਿਹੜਾ ਸਾਰਾ ਮਾਨਸਿਕ ਤਨਾਅ ਗਾ ਉਹ ਦੂਰ ਹੋ ਜਾਂਦਾ ਗਾ ਅਸੀਂ ਜਦੋਂ ਵੀ ਯੋਗਾ ਕਰਨਾ ਸ਼ੁਰੂ ਕਰਦੇ ਆਂ ਸਾਨੂੰ ਕੋਈ ਵੀ ਬਿਮਾਰੀ ਹੁੰਦੀ ਆ ਅਸੀਂ ਯੋਗਾ ਕਰਨਾ ਸ਼ੁਰੂ ਕਰ ਦਿੰਦੇ ਆਂ ਤਾਂ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਤਾਂ ਘੱਟ ਜਾਂਦੀਆਂ ਅਸੀਂ ਆਪਣੇ ਜਿਹੜੀਆਂ ਬਿਮਾਰੀਆਂ ਤੇ ਨਿਰੰਤਰ ਕਾਬੂ ਪਾ ਲੈਨੇ ਆ ਯੋਗਾ ਨਾਲ ਸਾਡਾ ਜੀਵਨ ਬਹੁਤ ਹੀ ਮਨ ਸ਼ਾਂਤ ਹੋ ਜਾਂਦਾ ਜੀਵਨ ਠੀਕ ਹੋ ਜਾਂਦਾ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਸੀਂ ਤੰਦਰੁਸਤ ਹੋ ਜਾਦੇ ਆਂ ਯੋਗਾ ਕਰਦੇ ਆਂ ਸਾਡਾ ਮਾਨਸਿਕ ਤਨਾਅ ਦੂਰ ਹੋ ਜਾਂਦਾ ਜਦੋਂ ਅਸੀਂ ਯੋਗਾ ਕਰਦੇ ਆਂ ਸਾਡੇ ਸਰੀਰ ਦੇ ਵਿੱਚ ਤੰਦਰੁਸਤੀ ਆਉਂਦੀ ਆ ਸਾਨੂੰ ਕੋਈ ਵੀ ਟੈਨਸ਼ਨ ਨਹੀਂ ਰਹਿੰਦੀ ਦਿਮਾਗੀ ਟੈਂਸ਼ਨ ਦੂਰ ਹੋ ਜਾਂਦੀ ਆ ਅਸੀਂ ਯੋਗਾ ਕਰਕੇ ਸਾਰਾ ਕੁਛ ਮਨ ਦੀਆਂ ਪਰੇਸ਼ਾਨੀਆਂ ਭੁੱਲ ਜਾਦੇ ਆ ਸਾਡੇ ਸਰੀਰ ਚ ਦਰਦ ਘੱਟ ਜਾਂਦਾ ਯੋਗਾ ਕਰਨ ਨਾਲ ਅਸੀਂ ਜਦੋਂ ਵੀ ਤਾੜ ਆਸਨ ਕਰਦੇ ਆਂ ਸਿੱਧੇ ਖੜੇ ਹੋ ਕੇ ਤਾਂ ਸਾਡੇ ਜਿਹੜੇ ਕਮਰ ਤੇ ਗਰਦਨ ਦਾ ਦਰਦ ਆ ਉਹ ਦੂਰ ਹੋ ਜਾਂਦਾ